ਮਾਰਸ਼ਲ ਆਰਟ ਕਰਦਿਆਂ ਸਾਨੂੰ ਕੁਛ ਜ਼ਰੂਰੀ ਜਾਣਕਾਰੀ ਹੋਣੀ ਬਹੁਤ ਹੀ ਲਾਜ਼ਮੀ ਹੈ ਜਿਵੇਂ ਕਿ ਮਸ਼ਲ ਆਰਟ ਕਰਦਿਆਂ ਜਿਸ ਵੀ ਜਗ੍ਹਾ 'ਤੇ ਅਸੀਂ ਮਾਰਸ਼ਲ ਆਰਟ ਕਰਨਾ ਹੈ ਉਸ ਕਾਰਪਟ ਦੇ ਉੱਤੇ ਪ੍ਰੋਪਰ ਰੋਜ਼ ਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਇਨਫੈਕਸ਼ਨ ਤੋਂ ਬਚਿਆ ਜਾ ਸਕਿਆ ਅਤੇ ਮਾਰਸ਼ਲ ਆਰਟ ਕਰਦੇ ਸਮੇਂ ਆਪਣੇ ਮਾਸਟਰ ਦੀ ਗੱਲ ਨੂੰ ਪ੍ਰੋਪਰ ਵੇ ਨਾਲ ਸੁਣਨਾ ਚਾਹੀਦਾ ਹੈ ਤਾਂ ਕਿ ਕਮਨੀਕੇਸ਼ਨ ਕਰਦੇ ਵਕਤ ਕੋਈ ਵੀ ਗੱਲ ਇੱਧਰ ਉੱਧਰ ਨਾ ਗਲਤ ਸੋਚੀ ਜਾਵੇ ਅਤੇ ਜਦੋਂ ਮਾਰਸ਼ਲ ਆਰਟ ਕਰਦੇ ਹਾਂ ਸਾਨੂੰ ਆਪਣੇ ਤੋਂ ਛੋਟੇ ਬੰਦਿਆਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ ਜਦੋਂ ਮਾਰਸ਼ਲ ਆਰਟ ਕਰਨਾ ਸਿੱਖਣਾ ਹੈ ਤਾਂ ਸਾਨੂੰ ਪ੍ਰੋਪਰ ਸਿਟਿੰਗ 'ਚ ਬੈਠਣਾ ਚਾਹੀਦਾ ਹੈ ਤਾਂ ਕਿ ਸਾਡੀ ਰੀੜ੍ਹ ਦੀ ਹੱਡੀ ਵਿੱਚ ਵੀ ਕੋਈ ਪ੍ਰੋਬਲਮ ਨਾ ਆ ਸਕੇ ਕਿਉਂਕਿ ਮਾਰਸ਼ਲ ਆਰਟ ਕਰਦਿਆਂ ਸਮੇਂ ਸਾਨੂੰ ਆਪਣੀ ਬਾਡੀ ਨੂੰ ਸਹੀ ਤਰੀਕੇ ਨਾਲ ਲਾਜ਼ਮੀ ਹੈ ਜੇਕਰ ਆਪਾਂ ਗਲਤ ਮਾਸ਼ਲ ਆਰਟ ਕਰਾਂਗੇ ਤਾਂ ਸਾਡੇ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਮਾਰਸ਼ਲ ਆਰਟ ਕਰਦੇ ਸਮੇਂ ਸਾਨੂੰ ਹਰ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਮਾਰਸ਼ਲ ਆਰਟ ਕਰਨ ਨਾਲ ਸਾਨੂੰ ਬਹੁਤ ਹੀ ਵਧੀਆ ਫਾਇਦੇਮੰਦ ਹੈ ਕੁੜੀਆਂ ਵਾਸਤੇ ਤਾਂ ਮਾਰਸ਼ਲ ਆਰਟ ਬਹੁਤ ਹੀ ਵਧੀਆ ਹੈ ਕਿਉਂਕਿ ਉਹ ਆਪਣੀ ਸੇਫਟੀ ਕਰ ਸਕਦੀਆਂ ਹਨ ਅੱਜ ਕੱਲ੍ਹ ਦਾ ਮਾਹੌਲ ਜਿੱਦਾਂ ਵੇਖਿਆ ਜਾ ਸਕਦਾ ਹੈ ਕਿ ਬੱਚੀਆਂ ਸੇਫ ਨਹੀਂ ਹਨ ਇਸ ਕਰਕੇ ਮਾਰਸ਼ਲ ਆਰਟ ਹਰ ਕੁੜੀ ਨੂੰ ਆਉਣਾ ਚਾਹੀਦਾ ਹੈ ਅਤੇ ਬਹੁਤ ਹੀ ਵਧੀਆ ਹੈ